ਮੈਂ ਮਨ ਇੱਥੋਂ ਬੋਲਦੀ ਹਾਂ ਜੀ ਬਰਨਾਲਾ ਸਾਈਡ ਤੋਂ ਸਾਡੇ ਬੱਚੇ ਨੇ ਜੀ ਉਹ ਬਿਮਾਰ ਰਹਿੰਦੇ ਤੁਸੀਂ ਡੋਕਟਰ ਸਾਹਿਬ ਹੋ ਉਹ ਬਿਮਾਰ ਹੀ ਰਹਿੰਦੇ ਨੇ ਵੱਧਦੇ ਫੁੱਲਦੇ ਨਹੀਂ ਦੱਸੋ ਬਈ ਉਹਨੂੰ ਕਿਹੋ ਜਿਹਾ ਕੀ ਫੂਡ ਵਗੈਰਾ ਦਿਆ ਕਰੀਏ ਵੀ ਉਹ ਤੰਦਰੁਸਤ ਰਹਿਣ ਹਾਂਜੀ ਕੋਈ ਬਾਰਾਂ ਤੇਰਾਂ ਸਾਲ ਦਾ ਏ ਇਸ ਟਾਈਮ ਤਾਂ ਜੀ ਬਸ ਚਾਹ ਵਗੈਰਾ ਬਿਸਕੁਟ ਸਵੇਰੇ ਨਾਸ਼ਤਾ ਬਸ ਇਹੋ ਜਿਹੀਆਂ ਚੀਜ਼ਾਂ ਜੀ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਰੇਸ਼ਾ ਵੀ ਠੰਡ ਤੋਂ ਹੀ ਹੋ ਜਾਂਦਾ ਜੀ ਅੱਛਾ ਜੀ ਬੱਚੇ ਤਾਰ ਦਿੰਦੇ ਨੇ ਜੀ ਪਾਉਂਦੇ ਤਾਂ ਹੈਗੇ ਹਾਂ ਬੱਚੇ ਉਤਾਰ ਦਿੰਦੇ ਨੇ ਜਦੋਂ ਗਰਮੀ ਲੱਗਦੀ ਮਾੜੀ ਜੀ ਹਾਂਜੀ ਡੋਕਟਰ ਸਾਹਿਬ ਠੀਕ ਹੈ ਹਾਂਜੀ ਫਿਰ ਕੱਦ ਹਾਂਜੀ ਕੱਦ ਕੁੱਦ ਵਧਾਉਣ ਵਾਸਤੇ ਸਿਹਤ ਬਣਨ ਵਾਸਤੇ ਕੀ ਦੇਈਏ ਜੀ ਹਾਂਜੀ

ਹਾਂਜੀ ਧਿਆਨ ਤਾਂ ਬਹੁਤ ਰੱਖਦੇ ਹਾਂ ਫਿਰ ਵੀ ਬੱਚਾ ਵੀਕ ਕਰਕੇ ਨਾ ਜਲਦੀ ਬਿਮਾਰ ਹੋ ਜਾਂਦੇ ਨੇ ਗਰਮੀ 'ਚ ਵੀ ਗਰਮੀ 'ਚ ਵੀ ਜਲਦੀ ਹੋ ਜਾਂਦਾ ਸਰਦੀ 'ਚ ਵੀ ਹਾਂਜੀ ਉਹੀ ਖਾ ਲੈਂਦੇ ਨੇ ਜੀ ਪੀਜ਼ਾ ਵਗੈਰਾ ਜਾਂ ਕੁਛ ਜਿਵੇਂ ਆਹਾ ਪਾਸਤਾ ਵਗੈਰਾ ਖਾ ਲੈਂਦੇ ਨੇ ਉਹ ਮੈਦੇ ਦਾ ਹੁੰਦਾ ਜੀ

ਹਾਂਜੀ ਅੱਜ ਕੱਲ੍ਹ ਟਰੈਂਡ ਹੀ ਚੱਲਿਆ ਪਿਆ ਜੀ ਬੱਚੇ ਇਹੀ ਚੀਜ਼ਾਂ ਖਾਂਦੇ ਨੇ ਹਾਂਜੀ ਹਾਂਜੀ ਮੈਂ ਜ਼ਰੂਰ ਰੱਖੂਗੀ ਬਸ ਤੁਸੀਂ ਉਹੋ ਦੇ ਦਿਓ ਟਾਈਮ ਟੇਬਲ ਬਣਾ ਲੁੰਗੀ ਜੀ ਫੇਰ ਕੀ ਖਾਣ ਨੂੰ ਕਹੋਗੇ ਸਵੇਰੇ ਦੁਪਹਿਰੇ ਸ਼ਾਮ ਹਾਂਜੀ ਅੱਛਾ ਜੀ

ਹਾਂਜੀ ਠੀਕ ਹੈ ਜੀ ਓਕੇ